ਹਾਂਜੀ ਮੈਮ ਸੰਜੀਵ ਟੋਲੋ ਟੈਲੀਕੋਮ ਤੋਂ ਬੋਲ ਰਹੇ ਹੋ ਆਪ ਹਾਂਜੀ ਮੈਮ ਹਮਨੇ ਸਿੰਮ ਟਰਾਂਸਫਰ ਕਰਾ ਕਰਾਉਣਾ ਸੀਗਾ ਜੀ ਜੀ ਜੀਓ ਦਾ ਜੀਓ ਦਾ ਹੈ ਜੀ ਸਾਡੇ ਨੈਟਵਰਕ ਪ੍ਰੋਬਲਮ ਹੋ ਰਹੀ ਹੈ ਜੀ ਨੈਟਵਰਕ ਪ੍ਰੋਬਲਮ ਬਹੁਤ ਜ਼ਿਆਦਾ ਮੈਮ ਗੱਲ ਨਹੀਂ ਹੋ ਰਹੀ ਨੈੱਟ ਨਹੀਂ ਚਲਦਾ ਹਾਂਜੀ ਏਅਰਟੈੱਲ ਜੀ ਸਾਡੇ ਟਾਵਰ ਵਗੈਰਾ ਮਤਲਬ ਏਅਰਟੈੱਲ ਦੇ ਜ਼ਿਆਦਾ ਰੇਂਜ ਆ ਰਹੀ ਹੈ ਜੀ ਤਾਂ ਕਰਕੇ ਓਕੇ ਮੈਮ ਓਕੇ ਮੈਮ ਓਕੇ ਮੈਮ ਓਕੇ ਮੈਮ ਕਿੰਨੇ ਟਾਈਮ 'ਚ ਹੋਜੂਗਾ ਜੀ ਕਿੰਨੇ ਟਾਈਮ 'ਚ ਪੋਰਟ ਹੋਜੂਗਾ ਜੀ ਓਕੇ ਮੈਮ ਨੋ ਮੈਮ ਨੋ ਨੋ ਅੱਛਾ ਜੀ ਉਹਦਾ ਮਤਲਬ ਕੀ ਪ੍ਰੋਸੈਸ ਹੋੋਊਗਾ ਜੀ ਓਕੇ ਮੈਮ ਠੀਕ ਹੈ ਜੀ ਮੈਮ ਜੇ ਅ ਆਈਡੀਆ ਦਾ ਕਰਵਾਈਏ ਜੀ ਓਕੇ ਹਾਂਜੀ ਦੋਨੋਂ ਨੇ ਸਾਡੇ ਨਾ ਨੇੜੇ ਦੋਨਾਂ ਦੀ ਰੇਂਜ ਆਉਂਦੀ ਹੈ ਪਰ ਏਅਰਟੈਲ ਦੀ ਜ਼ਿਆਦਾ ਆਉਂਦੀ ਹੈ ਅਸੀਂ ਏਅਰਟੈੱਲ 'ਚ ਕਰਵਾਉਣਾ ਚਾਹਵਾਂਗੇ ਓਕੇ ਮੈਮ ਥੈਂਕ ਯੂ ਜੀ ਥੈਂਕ ਯੂ ਜੀ